ਜਿਵੇਂ ਮੈਂ ਅਭਿਆਸ ਤਾਂ ਬਹੁਤ ਕਰਦੀ ਹਾਂ ਹੈ ਨਾ ਆਪਦੇ ਡਾਂਸ ਦਾ ਪਰ ਮੈਂ ਜਿਹੜਾ ਆਪਦੇ ਮੇਰੇ ਡਾਂਸ ਦਾ ਹੁਨਰ ਆ ਉਸ ਨੂੰ ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਮੈਂ ਉਹਨੂੰ ਸੁਧਾਰ ਸਕਦੀ ਹਾਂ ਉਹਦੇ ਵਾਸਤੇ ਜਿਵੇਂ ਮੈਂ ਜ਼ਿਆਦਾਤਰ ਤਾਂ ਜਿਵੇਂ ਮੈਂ ਕਦੇ ਬਾਈ ਯੂਟਿਊਬ 'ਤੇ ਜਿਵੇਂ ਮੇਰੇ ਨਾਲ ਉਹ ਵੀ ਬੈਟਰ ਹੈ ਨਾ ਡਾਂਸਰ ਵਗੈਰਾ ਹੈਗਾ ਯੂਟੀਊਬ 'ਤੇ ਵੀਡੀਓ ਪਾਉਂਦੇ ਆ ਜਾਂ ਇਸਟਾਗ੍ਰਾਮ 'ਤੇ ਰੀਲ ਪਾਉਂਦੇ ਹਾਂ ਉਹਨਾਂ ਨੂੰ ਵੇਖ ਵੇਖ ਕੇ ਮੈਨੂੰ ਬੜੀ ਹੁੰਦਾ ਕਿ ਹੈ ਨਾ ਮੈਂ ਵੀ ਇਹਨਾਂ ਵਾਂਗੂੰ ਇੱਕ ਲੀਨੀਅਸ ਜਿਹੇ ਸਟੈਪ ਕਰਾਂ ਜਾਂ ਇੰਨੇ ਕਲੀਅਰ ਸਟੈਪ ਕਰਾਂ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਵੀ ਵਧੀਆ ਨੱਚਾਂ ਹੈ ਨਾ ਜਿਵੇਂ ਹੁਣ ਤਾਂ ਜਿਵੇਂ ਮੈਂ ਕਈ ਹੱਦ ਤੱਕ ਇੱਕ ਮੀਡੀਅਮ ਜਿਹੇ ਲੈਵਲ 'ਤੇ ਨੱਚ ਲੈਂਦੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਖੁਦ ਨੂੰ ਹੋਰ ਜ਼ਿਆਦਾ ਪ੍ਰੇਰਿਤ ਕਰਾਂ ਹੈ ਨਾ ਹੋਰ ਜ਼ਿਆਦਾ ਵਧੀਆ ਡਾਂਸ ਕਰਾਂ ਕਿ ਜਿਵੇਂ ਕਾਲਜ ਵਿੱਚ ਕੋਈ ਜਿਵੇਂ ਯੂਥ ਫੈਸਟੀਵਲ ਫੰਕਸ਼ਨ ਹੁਣ ਜਿਵੇਂ ਮੈਂ ਬੀਐਡ ਕਾਲਜ 'ਚ ਪੜ੍ਹਦੀ ਹਾਂ ਅਤੇ ਕੋਈ ਵਧੀਆ ਫੰਕਸ਼ਨ ਹੋਣ ਤਾਂ ਮੈਂ ਉਹਨਾਂ ਵਿੱਚ ਵੱਧ ਚੜ੍ਹ ਕੇ ਉਹਦੇ ਵਿੱਚ ਪਾਰਟੀਸਪੇਟ ਕਰ ਸਕਾਂ ਅਤੇ ਮੈਨੂੰ ਵਧੀਆ ਇੱਕ ਪ੍ਰਾਈਜ਼ ਵੀ ਮਿਲੇ ਤਾਂ ਜਿਹੜਾ ਮਤਲਬ ਕਿ ਇੱਕ ਆਪਾਂ ਕਿਸ ਸਨਮਾਨਿਤ ਹੋਣਾ ਹੈ ਨਾ ਉਹੀ ਇੱਕ ਸਭ ਤੋਂ ਵੱਡਾ ਇੱਕ ਪ੍ਰੇਰਿਤ ਹੈਗਾ ਜਾਂ ਆਪਾਂ ਇੱਕ ਬਲੈਸਿੰਗਸ ਲੈਣਾ ਹੈ ਨਾ ਸਟੇਜ 'ਤੇ ਖੜ੍ਹ ਕੇ ਬਲੈਸਿੰਗਸ ਲੈਣਾ ਇੱਕ ਬਹੁਤ ਵੱਡਾ ਆਪਦੇ ਆਪ 'ਚ ਇੱਕ ਬਹੁਤ ਵੱਡੀ ਅਚੀਵਮੈਂਟ ਆ ਹੈ ਨਾ ਜਿਸ ਨੂੰ ਹਰ ਕੋਈ ਪਾਉਣਾ ਚਾਹੁੰਦਾ

ਜਿਵੇਂ ਦਾ ਮਰਜ਼ੀ ਬੱਚਾ ਉਹ ਹਰ ਕੋਈ ਚਾਹੁੰਦਾ ਕਿ ਕੋਈ ਮੇਰੀ ਪ੍ਰੇਜ ਕਰੇ ਕੋਈ ਮੇਰੀ ਕੋਈ ਮੈਨੂੰ ਵਧੀਆ ਬਲੈਸਿੰਗ ਦਵੇ ਹੈ ਨਾ ਆਉਣ ਵਾਲੇ ਟਾਈਮ ਵਿੱਚ ਮੈਨੂੰ ਫਿਊਚਰ ਵਾਸਤੇ ਕੋਈ ਵਧੀਆ ਬਲੈਸਿੰਗਸ ਦੇਣ ਤਾਂ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਕਿ ਮੈਂ ਵਧੀਆ ਆਪਣਾ ਹੈ ਨਾ ਵਧੀਆ ਡਾਂਸ ਕਰਾਂ ਅਤੇ ਹੁਣ ਜਿਵੇਂ ਮੈਨੂੰ ਡਾਂਸ ਕਰਨਾ ਪਸੰਦ ਆ ਤਾਂ ਉਹੀ ਆ ਮੈਨੂੰ ਐਈਂ ਹੁੰਦਾ ਕਿ ਜਦੋਂ ਕੋਈ ਕਾਲਜ ਵਿੱਚ ਪ੍ਰੋਗਰਾਮ ਹੋਵੇ ਅਤੇ ਮੈਂ ਉੱਥੇ ਵਧੀਆ ਡਾਂਸ ਕਰਾਂ ਮੈਨੂੰ ਸਾਰੇ ਮੈਨੂੰ ਵੇਖਣ ਕਿ ਹਾਂ ਕਿ ਬੱਚਾ ਕਿੰਨਾ ਵਧੀਆ ਨੱਚ ਰਿਹਾ ਹੈ ਨਾ ਮੇਰੇ ਘਰ ਦੇ ਵੀ ਹੋਣ ਮੇਰੇ ਘਰ ਦੇ ਵੀ ਮੈਨੂੰ ਉੱਥੇ ਓਬਜਰਵ ਕਰਨ ਕਿ ਹਾਂ ਵੀ ਸਾਡੀ ਕੁੜੀ ਕਿੰਨਾ ਵਧੀਆ ਉੱਥੇ ਡਾਂਸ ਕਰ ਰਹੀ ਹੈ ਸਟੇਜ 'ਤੇ ਹੈ ਨਾ ਉਹਦੇ ਵਿੱਚ ਕਿੰਨਾ ਕੌਫੀਡੈਂਸ ਲੈਵਲ ਹੈ ਤਾਂ ਡਾਂਸ ਜੇ ਕਰਾਂਗੇ ਤਾਂ ਆਪਣਾ ਕੋਂਫੀਡੈਂਸ ਲੈਵਲ ਬੂਸਟ ਹੋਊਗਾ ਤਾਂ ਜਦੋਂ ਕੋਂਫੀਡੈਂਸ ਹੈਗਾ ਜੇ ਕੋਂਫੀਡੈਂਸ ਹੈਗਾ ਤਾਂ ਆਪਾਂ ਦੁਨੀਆਂ ਦੀ ਹਰ ਇੱਕ ਚੀਜ਼ ਨੂੰ ਕਰ ਸਕਦੇ ਹਾਂ ਹੈ ਨਾ ਕੋਂਫੀਡੈਂਸ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਅਤੇ ਸਟੇਜ 'ਤੇ ਖੜ੍ਹ ਕੇ ਨੱਚਣਾ ਉਹ ਵੀ ਇੱਕ ਬਹੁਤ ਵੱਡਾ ਆਪਦੇ ਆਪ 'ਚ ਕੋਨਫੀਡੈਂਸ ਆ ਅਤੇ ਉਹਦੇ ਵਾਸਤੇ ਜਦੋਂ ਆਪਾਂ ਨੂੰ ਪਰੈਸਿੰਗਸ ਮਿਲਦੀਆਂ ਨੇ ਜਾਂ ਆਪਾਂ ਨੂੰ ਪ੍ਰਾਈਜ਼ ਵਗੈਰਾ ਮਿਲਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਕਿ ਹਾਂ ਬਈ ਇਹ ਡਾਂਸ 'ਚ ਹੋਰ ਜਿਵੇਂ ਅੱਜਕੱਲ੍ਹ ਤਾਂ ਜਿਵੇਂ ਡਿਸਟਰਿਕ ਲੈਵਲ 'ਤੇ ਡਾਂਸ ਵਗੈਰਾ ਹੁੰਦੇ ਨੇ ਹੈ ਨਾ ਫਿਰ ਉਹਨਾਂ 'ਤੇ ਉਹਨਾਂ 'ਚ ਜੇ ਆਪਾਂ ਪਾਸਟ ਪਾਰਟੀਸਪੇਟ ਕਰਦੇ ਹਾਂ ਆਪਾਂ ਨੂੰ ਵਧੀਆ ਡਾਂਸ ਸਰਟੀਫਿਕੇਟ ਮਿਲਦਾ ਉਹਨਾਂ ਸਰਟੀਫਿਕੇਟ ਨਾਲ ਵਧੀਆ ਆਪਾਂ ਨੂੰ ਗ੍ਰੇਸਿੰਗ ਨੰਬਰ ਵੀ ਮਿਲਦੇ ਆ ਮੈਂ ਤਾਂ ਐਵੇਂ ਕਰਕੇ ਮਤਲਬ ਜਿਹੜਾ ਮੇਰਾ ਅਭਿਆਸ ਆ ਜਿਹੜਾ ਮੇਰਾ ਹੁਨਰ ਆ ਔਰ ਉਸਨੂੰ ਮੈਂ ਆਉਣ ਵਾਲੇ ਸਮੇਂ 'ਚ ਜ਼ਿਆਦਾਤਰ ਸੁਧਾਰਨਾ ਹੀ ਸੁਧਾਰਨ ਦੀ ਕੋਸ਼ਿਸ਼ ਕਰਦੀ ਰਹਾਂਗੀ ਕਿਉਂਕਿ ਮੈਂ ਖੁਦ ਨੂੰ ਵੈਸਟ ਦੇਣਾ ਚਾਹੁੰਦੀ ਹਾਂ ਅਤੇ ਮੈਂ ਵਧੀਆ ਪ੍ਰੇਰਿਤ ਰਹਿੰਦੀ ਹਾਂ ਕਿ ਮੇਰੇ ਪੇਰੈਂਟਸ ਵੀ ਮੈਨੂੰ ਵੇਖਣ ਮੈਨੂੰ ਫੋਨ 'ਤੇ ਵੇਖਣ ਜਦੋਂ ਮੇਰੀ ਵੀਡੀਓਸ ਰਿਕਾਰਡ ਕਰਨ ਉਹ ਸਾਡੇ ਰਿਸ਼ਤੇਦਾਰਾਂ 'ਚ ਭੇਜਣ ਕਿ ਵੀ ਸਾਡੀ ਕੁੜੀ ਇੰਨਾ ਸੋਹਣਾ ਡਾਂਸ ਕਰਦੀ ਹੈ ਇਸਨੂੰ ਹਰ ਇੱਕ ਵਧੀਆ ਸਟੈਪ ਜਿਹੜੇ ਆ ਉਹ ਕਿੰਨੇ ਉਹਦੇ ਕਲੀਅਰ ਆ ਹਰ ਇੱਕ ਸਟੈਪ ਉੱਭਰ ਉੱਭਰ ਕੇ ਆਵੇ ਮੇਰਾ ਅਤੇ ਮੈਂ ਵਧੀਆ ਡਾਂਸ ਕਰਾਂ ਅਲੱਗ ਅਲੱਗ ਸੱਭਿਆਚਾਰਿਕ ਡਾਂਸ ਕਰਾਂ ਹੈ ਨਾ ਹੋਰ ਵੀ ਜਿਵੇਂ ਆਪਣੇ ਇੰਡੀਆ ਦੇ ਬਹੁਤ ਸਾਰੇ ਸਟੇਟ ਦੇ ਅਲੱਗ ਅਲੱਗ ਡਾਂਸ ਨੇ ਉਹ ਵੀ ਡਾਂਸ ਮੈਂ ਸਿੱਖਾਂ ਉਹਨਾਂ ਨੂੰ ਸਿੱਖਣ ਦੇ ਵੀ ਮੇਰੇ ਅੰਦਰ ਬਹੁਤ ਵੱਡੀ ਚਾਅ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ